ਸਤਿ ਸ਼੍ਰੀ ਅਕਾਲ ਸਰ ਤੁਸੀਂ ਸ਼ਿਵ ਆਟੋ ਮੋਬਾਇਲਸ ਤੋਂ ਗੱਲ ਕਰਦੇ ਸਰ ਮੈਨੂੰ ਨਾ ਕੱਲ੍ਹ ਲਈ ਕੈਬ ਬੁੱਕ ਕਰਵਾਉਣੀ ਸੀਗੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀਗੀ ਕਿ ਜਿਹੜੇ ਤੁਹਾਡੇ ਡਰਾਈਵਰ ਆ ਕਿੰਨੇ ਤੋਂ ਕਿੰਨੇ ਤੱਕ ਅਵੇਲੇਬਲ ਹੁੰਦੇ ਆ ਸਰ ਐਕਚੁਲੀ ਮੇਰਾ ਨਾ ਕੱਲ ਇਗਜ਼ਾਮ ਹੈਗਾ ਆ ਮੈਂ ਸਵੇਰੇ ਚਾਰ ਵਜੇ ਨਿਕਲਣਾ ਆ ਉੱਥੋਂ ਮਤਲਬ ਘਰੋਂ ਆਪਣੇ ਘਰੋਂ ਪਠਾਨਕੋਟ ਤੋਂ ਨਿਕਲਣਾ ਮੈਂ ਪਠਾਨਕੋਟ ਸਰ ਮੈਂ ਪਠਾਨਕੋਟ ਸਾਡਾ ਪਿੰਡ ਜਿਹੜਾ ਹੈਗਾ ਆ ਇਹ ਆ ਟੇਸੀਆਂ ਪਿੰਡ ਆ ਸੁਜਾਨਪੁਰ ਸਾਨੂੰ ਸ਼ਹਿਰ ਪੈਂਦਾ ਆ ਅਤੇ ਉਸ ਤੋਂ ਪੰਜ ਕੁ ਕਿਲੋਮੀਟਰ ਅੱਗੇ ਇਹ ਪਿੰਡ ਪੈਂਦਾ ਆ ਜਦੋਂ ਵੈਸੇ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਾਂਗੀ ਅਤੇ ਤੁਸੀਂ ਉਹਦੇ 'ਤੇ ਉਸ ਲੋਕੇਸ਼ਨ ਦੇ ਅਕੋਰਡਿੰਗ ਤੁਸੀਂ ਆ ਜਾਇਓ ਅਤੇ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਮੈਂ ਜਾਣਾ ਕਿੱਥੇ ਵੈਸੇ ਤੁਹਾਨੂੰ ਦੱਸਤਾ ਜਿੱਦਾਂ ਮੈਂ ਸਵੇਰੇ ਚਾਰ ਵਜੇ ਇੱਥੋਂ ਨਿਕਲਣਾ ਹੈਗਾ ਆ ਮੇਰਾ ਐਗਜ਼ਾਮ ਹੈਗਾ ਆ ਜਲੰਧਰ ਅਤੇ ਮੈਂ ਜਲੰਧਰ ਕਿਸੇ ਵੀ ਹਾਲਤ 'ਚ ਦਸ ਵਜੇ ਪੁੱਜਣਾ ਕਿਉਂਕਿ ਦਸ ਤੋਂ ਪਹਿਲਾਂ ਮੇਰੀ ਐਂਟਰੀ ਹੋ ਜਾਣੀ ਆ ਅੱਧਾ ਘੰਟਾ ਪਹਿਲਾਂ ਮੇਰੀ ਇਗਜ਼ਾਮ ਦੀ ਐਂਟਰੀ ਹੋ ਜਾਣੀ ਆ ਅਤੇ ਮੇਰੇ ਕੋਲ ਸਮਾਨ ਵੀ ਕਾਫ਼ੀ ਜ਼ਿਆਦਾ ਹੋਣਾ ਆ ਅਤੇ ਐਕਸਪੈਂਸਿਵ ਸਮਾਨ ਹੈ ਤੁਹਾਨੂੰ ਪਤਾ ਮੇਕਅਪ ਆਰਟਿਸਟ ਹਾਂ ਮੈਂ ਅਤੇ ਮੇਕਅਪ ਦਾ ਸਮਾਨ ਬਹੁਤ ਐਕਸਪੈਂਸਿਵ ਹੁੰਦਾ ਆ ਲੱਖ ਤੋਂ ਉੱਤੇ ਉੱਤੇ ਦੀ ਵੈਨਿਟੀ ਹੋਣੀ ਅਤੇ ਮੈਨੂੰ ਬਿਲਕੁਲ ਸੇਫ ਡਰਾਈਵਰ ਚਾਹੀਦਾ ਹੈ ਜਿਹੜਾ ਮੇਰੇ ਸਮਾਨ ਨੂੰ ਵੀ ਹਾਮ ਨਾ ਕਰੇ ਅਤੇ ਮੈਨੂੰ ਵੀ ਹਾਮ ਨਾ ਕਰੇ ਪਹਿਲੀ ਚੀਜ਼ ਠੀਕ ਹੈ ਅਤੇ ਦੂਸਰੀ ਚੀਜ਼ ਜਿਹੜਾ ਮੈਂ ਦਸ ਵਜੇ ਪਹੁੰਚਣਾ ਆ ਉੱਥੇ ਉਹ ਮੈਨੂੰ ਟਾਈਮ 'ਤੇ ਪਹੁੰਚਾ ਦੇ ਮੈਨੂੰ ਜਲਦੀ ਉੱਠਣ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਕਹਿੰਦੇ ਕਿ ਸਾਢੇ ਤਿੰਨ ਤੁਹਾਡਾ ਡਰਾਈਵਰ ਆ ਜਾਊਗਾ ਕੋਈ ਇਸ਼ੂ ਨਹੀਂ ਹੈਗਾ ਸਾਢੇ ਤਿੰਨ ਉਠ ਜਾਂਗੇ ਬਟ ਇਹ ਕਿ ਮੈਨੂੰ ਉੱਥੇ ਟਾਈਮ 'ਤੇ ਪੁੱਜਣਾ ਹੈਗਾ ਅਤੇ ਦਸ ਮਤਲਬ ਦਸ ਵਜੇ ਤੋਂ ਪਹਿਲਾਂ ਪਹਿਲਾਂ ਮੈਂ ਉੱਥੇ ਪਹੁੰਚਣਾ ਆ ਮੇਰੀ ਸਾਢੇ ਨੋਂ ਤੋਂ ਸਾਢੇ ਨੋਂ ਵਜੇ ਤੱਕ ਐਂਟਰੀ ਹੋ ਜਾਣੀ ਆ ਅਤੇ ਇਸ ਕਰਕੇ ਤੁਸੀਂ ਮੈਨੂੰ ਪਹਿਲੀ ਗੱਲ ਤਾਂ ਚਾਰਜਸ ਆਪਣੇ ਦੱਸ ਦਿਓ ਕੀ ਆ ਤੁਹਾਡੇ ਇੱਥੋਂ ਮਤਲਬ ਸੁਜਾਨਪੁਰ ਤੋਂ ਲਗਾ ਲਓ ਤੁਸੀਂ ਸੁਜਾਨਪੁਰ ਤੋਂ ਜਲੰਧਰ ਤੱਕ ਜਾਣ ਦੇ ਕੀ ਚਾਰਜਿਸ ਆ ਟੋਲ ਵਗੈਰਾ ਇੰਕਲੂਡ ਕਰਕੇ ਦਿੰਦੇ ਆ ਜਾਂ ਫਿਰ ਐਕਸਕਲੂਡ ਕਰ ਕੇ ਦਿੰਦੇ ਆ ਉਹ ਮੈਨੂੰ ਦੱਸ ਦਿਓ ਕਿ ਟੋਲ ਦਾ ਵਿੱਚ ਹੀ ਹੋਊਗਾ ਕਿ ਜਾਂ ਫਿਰ ਐਕਸਟਰਾ ਮੈਨੂੰ ਖੁਦ ਪੇ ਕਰਨਾ ਪਊਗਾ ਅਤੇ ਨੈਕਸਟ ਥਿੰਗ ਆਪਣੇ ਜਿਹੜਾ ਤੁਹਾਡਾ ਡਰਾਈਵਰ ਹੈਗਾ ਆ ਜੋ ਵੀ ਹੈਗਾ ਜਿਹਨੂੰ ਵੀ ਤੁਸੀਂ ਭੇਜਣਾ ਹੈਗਾ ਕੈਬ ਵਾਲੇ ਨੂੰ ਉਹਦਾ ਮੈਨੂੰ ਨੰਬਰ ਉਹਦੀ ਪ੍ਰੋਫਾਈਲ ਉਹਦਾ ਆਧਾਰ ਕਾਰਡ ਵਗੈਰਾ ਸਭ ਕੁਝ ਮੈਨੂੰ ਸ਼ੇਅਰ ਕਰ ਦਿਓ ਤਾਂ ਕਿ ਉਹ ਮੈਂ ਆਪਣੇ ਫਾਦਰ ਸਾਹਿਬ ਨੂੰ ਅੱਗੇ ਮਤਲਬ ਟਰਾਂਸਫਰ ਉਹਨਾਂ ਨੂੰ ਅੱਗੇ ਸ਼ੇਅਰ ਕਰ ਦਾਂ ਤਾਂ ਕਿ ਕੱਲ੍ਹ ਨੂੰ ਕੋਈ ਦਿੱਕਤ ਨਾ ਹੋਵੇ ਅਤੇ ਫਿਰ ਵਾਪਸੀ ਮੇਰੀ ਜਿਹੜੀ ਹੈਗੀ ਆ ਉਹ ਕਰੀਬ ਕਰੀਬ ਜੇ ਮੇਰਾ ਪੇਪਰ ਬਾਰਾਂ ਵਜੇ ਖਤਮ ਹੋ ਗਿਆ ਵੈਸੇ ਤਾਂ ਦੋ ਘੰਟੇ ਦਾ ਹੈਗਾ ਬਾਰਾਂ ਨਹੀਂ ਤਾਂ ਸਾਢੇ ਬਾਰਾਂ ਤੱਕ ਖਤਮ ਹੋ ਜਾਣਾ ਆ ਅਤੇ ਸਾਢੇ ਬਾਰਾਂ ਤੋਂ ਬਾਅਦ ਵਾਪਸੀ ਹੋ ਜਾਣੀ ਆ ਤਾਂ ਮੈਨੂੰ ਆਉਣ ਜਾਣ ਦਾ ਦੋਨਾਂ ਦਾ ਕਿਰਾਇਆ ਪਲੀਜ਼ ਦੱਸ ਦਿਓ ਮੇਰਾ ਇਹ ਹੀ ਸੇਮ ਨੰਬਰ ਆ ਅਤੇ ਮੈਨੂੰ ਇਹ ਹੀ ਸੇਮ ਨੰਬਰ 'ਤੇ ਸਾਰੀ ਡਿਟੇਲਸ ਆਪਣੀ ਸ਼ੇਅਰ ਕਰ ਦਿਓ ਆਪਣੇ ਡਰਾਈਵਰ ਦੀ ਪਲਸ ਜਿਹੜਾ ਮਤਲਬ ਜੋ ਵੀ ਰੈਂਟ ਵਗੈਰਾ ਹੈਗਾ ਆ ਜੋ ਵੀ ਉਹਦੇ ਚਾਰਜਸ ਹੋਣਗੇ ਉਹਦੀ ਡਿਟੇਲ ਸੈਂਡ ਕਰ ਦਿਓ ਠੀਕ ਹੈ ਥੈਂਕ ਯੂ